ਸਤਿ ਸ਼੍ਰੀ ਅਕਾਲ ਜੀ ਮੈਂ ਮਨੀਸ਼ ਕੁਮਾਰ ਪਿੰਡ ਕੋਟਲੇ ਤੋਂ ਬੋਲ ਰਿਹਾਂ ਜੀ ਮੈਂ ਸੈਮਸੰਗ ਦਾ ਮੋਬਾਇਲ ਮੰਗਾਇਆ ਸੀਗਾ ਜੋ ਕਿ ਪੰਦਰਾਂ ਹਜ਼ਾਰ ਦੀ ਕੀਮਤ ਦਾ ਸੀ ਅਤੇ ਮੇਰਾ ਜਿਹੜਾ ਐੱਡਰਸ ਹੈ ਉਹ ਥੋੜ੍ਹਾ ਜਿਹਾ ਏਰੀਆ ਉਹਨੂੰ ਪਤਾ ਨਹੀਂ ਲੱਗਿਆ ਡਿਲੀਵਰੀ ਬੋਆਏ ਨੂੰ ਅਤੇ ਮੈਨੂੰ ਆਪਣਾ ਬੜੀ ਉਮੀਦ ਸੀਗੀ ਕਿ ਅੱਜ ਮੈਨੂੰ ਮੇਰਾ ਮੋਬਾਇਲ ਮਿਲ ਜਾਏਗਾ ਅਤੇ ਨਾ ਹੀ ਉਸ ਲੜਕੇ ਨੇ ਮੈਨੂੰ ਫੋਨ ਕੀਤਾ ਅਤੇ ਨਾ ਮੇਰਾ ਜਿਹੜਾ ਹੈ ਆਰਡਰ ਸੀਗਾ ਉਹ ਉਹਨੇ ਕੈਂਸਲ ਕਰ ਦਿੱਤਾ ਮੈਂ ਇਸ ਲ ਕਰਕੇ ਇੱਕ ਤੁਹਾਨੂੰ ਨਵਾਂ ਐੱਡਰਸ ਭੇਜ ਰਿਹਾ ਹਾਂ ਜਿਸ ਕਰਕੇ ਮੈਨੂੰ ਬੜੀ ਉਹ ਤੰਗੀ ਹੋਈ ਹੈ ਅਤੇ ਮੈਂ ਤੁਹਾਨੂੰ ਨਵਾਂ ਐੱਡਰਸ ਭੇਜ ਰਿਹਾ ਹੈ ਕਿਰਪਾ ਕਰਕੇ ਮੈਨੂੰ ਨਵੇਂ ਐੱਡਰਸ 'ਤੇ ਮੇਰਾ ਮੋਬਾਇਲ ਭੇਜਣ ਦੀ ਕੋਸ਼ਿਸ਼ ਕਰੋ ਜੀ ਧੰਨਵਾਦ